ਹਾਂਜੀ ਨਮਸਕਾਰ ਜੀ ਮੇਰਾ ਨਾਮ ਸ਼ਸ਼ੀ ਹੈ ਮੈਂ ਇਸਲਾਮਾਬਾਦ ਮੁਹੱਲੇ ਦੀ ਰਹਿਣ ਵਾਲੀ ਹੈ ਗੁਰਦਾਸਪੁਰ ਦੀ ਅਤੇ ਹਾਂਜੀ ਜਦੋਂ ਤੁਸੀਂ ਜਦੋਂ ਅਸੀਂ ਲਗਾਤਾਰ ਮਸ਼ੀਨ ਦਾ ਕੰਮ ਕਰਦੇ ਹਾਂ ਘਰ ਦੇ ਰਜੀਨ ਦੇ ਨਾਲ ਵੀ ਘਰ ਦੀ ਰੁਟੀਨ ਦੇ ਵਿੱਚ ਜਿਹੜਾ ਕੰਮ ਕਰਨਾ ਮਸ਼ੀਨ ਵਾਲਾ ਹੋਣਾ ਤੇ ਉਹਦੇ ਨਾਲ ਥੋੜ੍ਹਾ ਬਹੁਤਾ ਸਰੀਰ ਨੂੰ ਦੇ ਫ਼ਰਕ ਪੈਂਦਾ ਹੀ ਹੈ ਕਿਉਂਕਿ ਲਗਾਤਾਰ ਵੀ ਜੇ ਅਸੀਂ ਮਸ਼ੀਨ ਨੂੰ ਚਲਾਉਂਦੇ ਹਾਂ ਤਾਂ ਸਾਡੇ ਜਿਹੜੀ ਮੋਢਿਆਂ ਦੇ ਹੈਗੀ ਉਹਨਾਂ 'ਚ ਦਰਦ ਹੋਣ ਲੱਗ ਪੈਂਦੀ ਆ ਅਤੇ ਪਰ ਅੱਜ ਕੱਲ੍ਹ ਦੀ ਟੈਕਨੀਕ ਨਾਲ ਜਿਵੇਂ ਵੀ ਪੈਰਾਂ ਵਾਲੀ ਮਸ਼ੀਨ ਹੈਗੀ ਆ ਉਹਦੇ ਨਾਲ ਇੰਨੀ ਥਕਾਵਟ ਤਾਂ ਨਹੀਂ ਹੁੰਦੀ ਪਰ ਫਿਰ ਵੀ ਜ਼ਿਆਦਾ ਟਾਈਮ ਮਸ਼ੀਨ ਦੇ ਨਾਲ ਬੈਠ ਕੇ ਕੰਮ ਕਰਨਾ ਅਤੇ ਓਦਾਂ ਥੋੜ੍ਹੀ ਬਹੁਤੀ ਤਾਂ ਪ੍ਰੋਬਲਮ ਆਉਂਦੀ ਹੀ ਹੈ ਅਤੇ ਲਗਾਤਾਰ ਤਾਂ ਨਹੀਂ ਮਸ਼ੀਨ 'ਤੇ ਬੈਠਿਆ ਜਾਂਦਾ ਪਰ ਫਿਰ ਵੀ ਆਪਣੇ ਰੁਝਾਨ ਨੂੰ ਟਾਈਮ ਕੱਢ ਕੇ ਹੀ ਬੈਠਿਆ ਜਾਂਦਾ ਆ ਫਿਰ ਵੀ ਘਰ ਦੀ ਰੁ ਕੰਮਾਂ ਤੋਂ ਵਿਹਲੇ ਹੋ ਕੇ ਘੰਟਾ ਦੋ ਘੰਟੇ ਕੱਢਣੇ ਪੈਂਦੇ ਆ ਅਤੇ ਅਸੀਂ ਕਹਿੰਦੇ ਹਾਂ ਵੀ ਚਲੋ ਵੀ ਜੋ ਵੀ ਆਵੇਗਾ ਚਲੋ ਠੀਕ ਆ ਸਾਡੇ ਘਰ ਦਾ ਗੁਜ਼ਾਰਾ ਅੱਛੀ ਤਰ੍ਹਾਂ ਹੋ ਜਾਂਦਾ ਅੱਜ ਕੱਲ੍ਹ ਦੀ ਮਹਿੰਗਾਈ ਦੇ ਜਮਾਨੇ ਤੇ ਸਾਰ ਕਿਸੇ ਨੂੰ ਆਪਣੇ ਕੋਈ ਨਾ ਕੋਈ ਆਪਣੀ ਕਮਾਈ ਦਾ ਸਰੋਤ ਬਣਾਉਣਾ ਚਾਹੀਦਾ ਵਾ ਅਤੇ ਦਰਦਾਂ ਤਾਂ ਹੁੰਦੀਆਂ ਹੀ ਆ ਪਰ ਫਿਰ ਵੀ ਅਸੀਂ ਕੰਮ ਤਾਂ ਥੋੜ੍ਹਾ ਬਹੁਤਾ ਕਰਨਾ ਹੀ ਆ ਅਤੇ ਫਿਰ ਉਸ ਤੋਂ ਬਾਅਦ ਜੇ ਅਸੀਂ ਉਨ੍ਹਾਂ ਤੋਂ ਜੇ ਜ਼ਿਆਦਾ ਹੀ ਮਤ ਕ ਹੋਣ ਲੱਗ ਪਵੇ ਤਾਂ ਅਸੀਂ ਪੇਨ ਕਿਲਰ ਵਗੈਰਾ ਖਾ ਲੈਂਦੇ ਜਾਂ ਥੋੜ੍ਹੀ ਜਿਹੀ ਐਕਸਰਸਾਈਜ਼ ਵਗੈਰਾ ਕਰ ਲਈ ਦੀ ਹੈ ਜਿਹਦੇ ਨਾਲ ਵੀ ਆਹ ਮੋਢਿਆਂ ਨੂੰ ਰੈਸਟ ਮਿਲਦੀ ਹੈ ਅਤੇ ਹੋਰ ਵੀ ਡਾਇਟ ਆਪਣੀ ਚੰਗੀ ਰੱਖੀ ਜਾਵੇ ਤਾਂ ਇਹ ਮੁਸ਼ਕਲਾਂ ਵੀ ਘੱਟ ਹੀ ਆਉਂਦੀਆਂ ਨੇ ਵਿੱਚ ਥੋੜ੍ਹਾ ਥੋੜ੍ਹਾ ਕੰਮ ਕਰਦੇ ਰਹੋ ਥੋੜ੍ਹਾ ਥੋੜ੍ਹਾ ਫਿਰ ਲਵੋ ਲਗਾਤਾਰ ਵੀ ਨਹੀਂ ਮਸ਼ੀਨ 'ਤੇ ਬਹਿਣਾ ਚਾਹੀਦਾ ਕਿਉਂਕਿ ਜੇ ਅਸੀਂ ਲਗਾਤਾਰ ਵੀ ਬਹਿੰਦੇ ਹਾਂ ਤਾਂ ਸਾਡੀ ਯਾਨੀ ਬੈਕ ਸਾਈਡ ਦੀ ਪਿੱਠ 'ਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਆਪਣੀ ਸਿਹਤ ਨੂੰ ਮਜ਼ਾ ਰੱਖਣ ਨਾਲ ਰੱਖਦੇ ਹੋਏ ਸਾਨੂੰ ਲਗਾਤਾਰ ਮਸ਼ੀਨ 'ਤੇ ਨਹੀਂ ਬਹਿਣਾ ਚਾਹੀਦਾ ਅਤੇ ਵਿੱਚ ਵਿਚ ਰੈਸਟ ਕਰ ਲੈਣੀ ਚਾਹੀਦੀ ਜਿਹਦੇ ਨਾਲ ਵੀ ਸਾਡਾ ਸਰੀਰ ਵੀ ਠੀਕ ਰਹੇ ਤੇ ਆਪਣਾ ਸ਼ ਆਪਣਾ ਕੰਮ ਵੀ ਕਰ ਸਕੀਏ ਇਹ ਲਿਆ ਆਪਣਾ ਸਰੀਰ ਆ ਫਿਰ ਪੱਗ ਦਾ ਪਾ ਜੇ ਅਸੀਂ ਲਗਾਤਾਰ ਬੈਠੇ ਹੀ ਰਹਵਾਂਗੇ ਤੇ ਆਪਣੇ ਸਾਰੇ ਖਰਾਬ ਹੋ ਜਾ ਕਿਤੇ ਅਸੀਂ ਉਹ ਤਾਂ ਘੁੰਮਾਂ ਦੇ ਲਾਲਚ ਵਿੱਚ ਇਸ ਕਰਕੇ ਕਹਿੰਦੇ ਵੀ ਕੰਮ ਦੇ ਨਾਲ ਆਪਣੇ ਸਿਹਤ ਵੀ ਬਹੁਤ ਜ਼ਰੂਰੀ ਹੈ